ਸਾਡੇ ਪੰਜਾਬ ਦਾ ਵਿਰਸਾ ਬਹੁਤ ਹੀ ਉੱਚਾ ਅਤੇ ਸੁੱਚਾ ਹੈ ਇਸ ਵਿੱਚ ਬਹੁਤ ਸਾਰੇ ਕੰਮ ਹੱਥਾਂ ਨਾਲ ਕੀਤੇ ਜਾਂਦੇ ਹਨ ਪੁਰਾਣੇ ਸਮਿਆਂ ਵਿੱਚ ਜੋ ਵੀ ਸ਼ਿਲਪ ਬਹੁਤ ਸਾਰੇ ਕੰਮ ਸੀ ਉਹ ਔਰਤਾਂ ਘ ਘਰਾਂ ਵਿੱਚ ਹੱਥਾਂ ਨਾਲ ਕਰਦੀਆਂ ਸਨ ਸ਼ਿਲਪਕਾਰ ਮੰਜੇ ਬਣਾਉਂਦੇ ਸੀ ਚਰਖੇ ਬਣਾਉਂਦੇ ਸੰਦੂਕ ਬਣਾਉਂਦੇ ਅਲਮਾਰੀਆਂ ਪੇਟੀਆਂ ਲੱਕੜ ਦੀਆਂ ਬਣਾਈਆਂ ਜਾਂਦੀਆਂ ਸਨ ਜਿਹਨਾਂ ਉੱਪਰ ਬਹੁਤ ਹੀ ਸੁੰਦਰ ਢੰਗ ਨਾਲ ਕਲਾ ਕੀਤੀ ਜਾਂਦੀ ਸੀ ਜੋ ਕਿ ਦੇਖਣ ਵਿੱਚ ਬਹੁਤ ਹੀ ਸੁੰਦਰ ਲੱਗਦੇ ਸਨ ਮੰਜਿਆਂ ਉੱਪਰ ਵੀ ਬਹੁਤ ਵਧੀਆ ਸ਼ਿਲਪਕਾਰੀ ਕੀਤੀ ਜਾਂਦੀ ਸੀ ਉਹਨਾਂ ਦੇ ਪਾਵਿਆਂ ਦੇ ਉੱਪਰ ਤਰ੍ਹਾਂ ਤਰ੍ਹਾਂ ਦੇ ਡਿਜ਼ਾਇਨ ਬਣਾਏ ਜਾਂਦੇ ਸਨ ਸੰਦੂਖਾਂ ਉੱਪਰ ਵੀ ਕਈ ਤਰਹਾਂ ਦੇ ਪੰਛੀਆਂ ਦੇ ਡਿਜ਼ਾਇਨ ਕੋਈ ਫਲਾ ਫੁੱਲਾਂ ਦੇ ਡਿਜ਼ਾਇਨ ਬਣਾਏ ਜਾਂਦੇ ਸਨ ਪੇਟੀਆਂ ਵੀ ਬਹੁਤ ਹੀ ਸੁੰਦਰ ਲੱਕੜ ਨਾਲ ਤਿਆਰ ਕੀਤੀਆਂ ਜਾਂਦੀਆਂ ਸੀ ਚਰਖੇ ਵੀ ਸ਼ਿਲਪਕਾਰ ਆਪਣੇ ਘਰਾਂ ਵਿੱਚ ਹੀ ਤਿਆਰ ਕਰਾ ਕੇ ਕਰਦੇ ਸਨ ਇਹਨਾਂ ਸ਼ਿਲਪਕਾਰ ਹਲ ਚਰਖੇ ਲੱਕੜ ਦਾ ਹੋਰ ਬਹੁਤ ਸਾਰਾ ਸਮਾਨ ਘਰਾਂ ਵਿੱਚ ਬਣਾਉਂਦੇ ਸਨ ਸਾਡੇ ਘਰ ਦੇ ਵਿੱਚ ਔਰਤਾਂ ਚਰਖੇ ਉੱਪਰ ਸੂਤ ਕਤਦੀਆਂ ਘਰਾਂ ਵਿੱਚ ਖੇਸ ਤਿਆਰ ਕਰਦੀਆਂ ਚਾਦਰਾਂ ਉੱਪਰ ਬਹੁਤ ਸੋਹਣੇ ਸੋਹਣੇ ਡਿਜ਼ਾਇਨ ਬਣਾਉਂਦੀਆਂ ਉਹਨਾਂ ਉੱਪਰ ਫੁੱਲਾਂ ਦੇ ਪਸ਼ੂਆਂ ਦੇ ਪੰਛੀਆਂ ਦੇ ਚਿੱਤਰ ਬਣਾਉਂਦੀਆਂ ਸੀ ਉਹ ਫੁਲਕਾਰੀਆਂ ਕੱਢਦੀਆਂ ਫੁਲਕਾਰੀਆਂ ਜੋ ਕਿ ਸਾਡੇ ਪੰਜਾਬੀ ਵਿਰਸੇ ਦਾ ਗਹਿਣਾ ਕਿਹਾ ਜਾਂਦਾ ਹੈ ਫੁਲਕਾਰੀਆਂ ਨੂੰ ਬੈਕਸਾਈਡ ਤੋਂ ਬਹੁਤ ਹੀ ਸੁੰਦਰ ਢੰਗ ਨਾਲ ਕੱਢਿਆ ਜਾਂਦਾ ਸੀ ਜਿਹਨਾਂ ਉੱਪਰ ਬਹੁਤ ਸੋਹਣੇ ਸੋਹਣੇ ਡਿਜ਼ਾਇਨ ਪਾਏ ਜਾਂਦੇ ਸਨ ਔਰਤਾਂ ਘਰਾਂ ਵਿੱਚ ਬਾਗ ਬਾਗ ਬਣਾਉਂਦੀਆਂ ਜੋ ਕਿ ਬਹੁਤ ਹੀ ਦੇਖਣ ਵਿੱਚ ਸੁੰਦਰ ਲੱਗਦੇ ਸੀ ਘਰਾਂ ਵਿੱਚ ਹੀ ਰੁਮਾਲ ਉਹਨਾਂ ਉੱਪਰ ਕਢਾਈ ਕੀਤੀ ਜਾਂਦੀ ਸੀ ਨਾਲੇ ਵੀ ਔਰਤਾਂ ਘਰਾਂ ਵਿੱਚ ਪੱਛਮ ਦੇ ਤਿਆਰ ਕਰਦਾ ਕ ਕਰਦੀਆਂ ਸਨ ਸਾਡੇ ਪਿੰਡਾਂ ਦਾ ਵਿਰਸਾ ਪੰਜਾਬ ਦਾ ਵਿਰਸਾ ਬਹੁਤ ਹੀ ਉੱਚਾ ਅਤੇ ਸੁੱਚਾ ਹੈ ਜਿਸ ਵਿੱਚ ਮੰਜਿਆਂ ਨੂੰ ਘਰਾਂ ਮੰਜੇ ਘਰਾਂ ਵਿੱਚ ਹੀ ਬੁਣੇ ਜਾਂਦੇ ਸੀ ਜੋ ਕਿ ਸੂਤ ਘਰ ਵਿੱਚ ਪਹਿਲਾਂ ਸ ਚਰਖੇ ਉੱਪਰ ਕੱਤ ਕੇ ਫੇਰ ਉਹਨਾਂ ਦੇ ਰੰਗ ਕਰਕੇ ਫਿਰ ਉਹਨਾਂ ਦੇ ਮੰਜੇ ਬਣਾਏ ਜਾਂਦੇ ਸੀ ਜੋ ਕਿ ਵੇਖਣ ਵਿੱਚ ਬਹੁਤ ਹੀ ਸੁੰਦਰ ਹੁੰਦੇ ਸਨ ਸਾਡੇ ਦੇਸ਼ ਦੀ ਪਰੰਪਰਾ ਬਹੁਤ ਹੀ ਵਧੀਆ ਹੈ ਜੋ ਕਿ ਬਹੁਤ ਹੀ ਉੱਚੀ ਅਤੇ ਸੁੱਚੀ ਹੈ